ਹਾਂ ਮੇਰਾ ਮਨਪੰਸਦੀਦਾ ਪਕਵਾਨ ਵੈਸੇ ਤਾਂ ਜਿਹੜਾ ਪੰਜਾਬ ਦੇ ਕਲਚਰ 'ਚ ਆਉਂਦਾ ਸਾਗ ਆ ਮੱਕੀ ਦੀ ਰੋਟੀ ਆ ਤਾਂ ਉਹ ਇੱਕ ਜਿਹੜਾ ਸਮੇਂ ਦੇ ਨਾਲ ਸੰਬੰਧਿਤ ਆ ਕਿਉਂਕਿ ਸਾਗ ਆ ਜਿਹੜਾ ਉਹ ਇੱਕ ਸੀਜਨਲ ਸਬਜ਼ੀ ਦੇ ਤੌਰ 'ਤੇ ਆ ਜਾਂਦਾ ਜਿਹੜਾ ਠੰਡ ਦੇ ਵਿੱਚ ਜਾਂ ਕੁਛ ਕੁ ਮਹੀਨੇ ਜਿਹੜਾ ਉਹ ਚੱਲਦਾ ਵੈਸੇ ਤਾਂ ਹਰ ਸਮੇਂ ਦੀ ਪਸੰਦ ਜਿਹੜੀ ਸਾਗ ਹੈ ਮੱਕੀ ਦੀ ਰੋਟੀ ਹੈ ਕਿਉਂਕਿ ਇਹ ਵੀ ਅਸੀਂ ਜਿਹੜੀ ਤਾਂ ਪੰਜਾਬ ਵਿੱਚ ਰਹਿੰਦੇ ਹੋਏ ਇੱਕ ਖਾਸ ਖੇਤਰ 'ਚ ਰਹਿੰਦੇ ਹੋਏ ਜਿਹੜੀ ਅਸੀਂ ਵਰਤਦੇ ਹਾਂ ਹੈ ਨਾ ਤਾਂ ਉਹ ਸਭ ਦੀ ਜਿਹੜੀ ਫੇਵਰੇਟ ਹੈ ਮਨਪਸੰਦ ਹੈ ਪੰਜਾਬੀਆਂ ਦੀ ਖਾਸ ਕਰਕੇ ਪਰ ਜਿਸ ਤਰ੍ਹਾਂ ਦੱਸਿਆ ਕਿ ਸਾਗ ਜਿਹੜਾ ਇੱਕ ਸਮੇਂ ਹੀ ਖਾਧਾ ਜਾ ਸਕਦਾ ਇੱਕ ਸੀਜ਼ਨ ਦੇ ਵਿੱਚ ਹੀ ਤਾਂ ਉਸ ਤੋਂ ਬਾਅਦ ਜਿਹੜੀ ਹਰ ਸਮੇਂ ਖਾਧੀ ਜਾਣ ਵਾਲੀ ਚੀਜ਼ ਹੈ ਉਹਦੇ ਵਿੱਚ ਹਾਂ ਖਾਸ ਕਰਕੇ ਜਿਹੜਾ ਸੀਜਨਲ ਹਰੀਆਂ ਸਬਜ਼ੀਆਂ ਜਾਂ ਪੰਜਾਬ ਦੇ ਵਿੱਚ ਆਮ ਹੀ ਜਿਹੜਾ ਮੱਖਣ ਜਾਂ ਦਹੀਂ ਜਿਹੜਾ ਉਹ ਵਰਤਿਆ ਜਾਂਦਾ ਤਾਂ ਉਹ ਹਰ ਸਮੇਂ ਜਿਹੜਾ ਖਾਣ ਵਾਲਾ ਪਕਵਾਨ ਆ ਉਹਨਾਂ ਦੇ ਨਾਲ ਜਿਹੜੀ ਕੋਈ ਵੀ ਪਰੌਂਠੇ ਰੱਖ ਲਉ ਦਹੀਂ ਦੇ ਨਾਲ ਜਿਹੜੇ ਹਰ ਸਮੇਂ ਜਿਹੜੇ ਉਹ ਖਾਧੇ ਜਾ ਸਕਦੇ ਆ ਤਾਂ ਇੱਕ ਜਿਹੜੀ ਦੇਸੀ ਪੰਜਾਬ ਦੀ ਇੱਕ ਖੁਰਾਕ ਆ ਜਾਂ ਦੇਸੀ ਜਿਹੜਾ ਖਾਣਾ ਦੇਸੀ ਪਕਵਾਨ ਆ ਘਰ ਦਾ ਉਹ ਹਰ ਸਮੇਂ ਦਾ ਹੀ ਜਿਹੜਾ ਮਨਪਸੰਦ ਰਹਿੰਦਾ ਲੈ ਵੀ